ਨੌ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਕਾਰਨ ਇਹੀ ਹੈ ਕਿ ਉਹ ਬੇਰੁਜ਼ਗਾਰ ਘੁੰਮ ਰਹੇ ਹਨ ਉਹਨਾਂ ਕੋਲ ਕੰਮ ਨਹੀਂ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਪੜ੍ਹੇ ਲਿਖੇ ਬੱਚੇ ਵੀ ਬੇਰੁਜ਼ਗਾਰ ਘੁੰਮ ਰਹੇ ਹਨ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕਮ ਸੇ ਕਮ ਉਹਨਾਂ ਨੂੰ ਪੰਦਰਾਂ ਹਜ਼ਾਰ ਤੱਕ ਸੈਲਰੀ ਤੱਕ ਹੀ ਰੱਖ ਲਉ ਉਹਨ ਉਹਨਾਂ ਦਾ ਧਿਆਨ ਇੱਕ ਲੱਗਾ ਰਹੇਗਾ ਕਿ ਅਸੀਂ ਇੱਕ ਕੰਮ 'ਤੇ ਜਾਣਾ ਹੈ ਜਾਂ ਇੱਕ ਕੰਮ ਕਰਨਾ ਆ ਇੱਕ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਉਹਨਾਂ ਨੂੰ ਇੱਕ ਕੰਮ 'ਤੇ ਰੱਖਣ ਕੋਈ ਵੀ ਐਸੀ ਬਥੇਰੀਆਂ ਪੋਸਟਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜਿਨ੍ਹਾਂ 'ਤੇ ਤੁਸੀਂ ਉਹਨਾਂ ਨੂੰ ਰੱਖ ਸਕਦੇ ਆਂ ਇਸ ਕਰਕੇ ਉਹ ਜਿਹੜੀਆਂ ਹੁਣ ਚੋਰੀਆਂ ਹੁੰਦੀਆਂ ਆ ਜਾਂ ਚੈਨਾਂ ਖੋਹ ਲੈਂਦੇ ਆ ਮੋਟਰਸਾਈਕਲ ਚੋਰੀ ਕਰ ਲੈਂਦੇ ਆਂ ਕਰ ਲੈਂਦੇ ਆ ਲੋਕਾਂ ਦੇ ਜਾਂਦੇ ਜਾਂਦੇ ਉਹ ਇਹ ਚੀਜ਼ ਹੋਣੀ ਨਹੀਂ ਚਾਹੀਦੀ ਜੇ ਤੁਸੀਂ ਉਹਨਾਂ ਨੂੰ ਨੌਜਵਾਨਾਂ ਨੂੰ ਨੌਕਰੀ ਦਿਉਗੇ ਤਾਂ ਬੇਰੁਜ਼ਗਾਰੀ ਵੀ ਖਤਮ ਹੋਊਗੀ ਔਰ ਇਹ ਚੋਰੀਆਂ ਵੀ ਘੱਟ ਜਾਣਗੀਆਂ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਤੁਸੀਂ ਨੌਜਵਾਨਾਂ ਨੂੰ ਦਸ ਦਸ ਪੰਦਰਾਂ ਪੰਦਰਾਂ ਹਜ਼ਾਰ 'ਤੇ ਜੋਬ ਦੇ ਸਕਦੇ ਆ